ਮੇਰੇ ਲਈ ਸਭ ਤੋਂ ਮਾਣ ਵਾਲੀ ਪ੍ਰਾਪਤੀ ਇਹ ਹੈ ਕਿ ਮੈਂ ਜਦੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਦੇ ਵਿੱਚ ਪੁਜ਼ੀਸ਼ਨ ਹਾਸਿਲ ਕੀਤੀ ਸੀਗੀ ਇਹ ਜ਼ਿਲ੍ਹਾ ਪੱਧਰੀ ਮੁਕਾਬਲਾ ਸੀਗਾ ਕਿ ਆਜ਼ਾਦੀ ਦੀ ਪੰਝੱਤਰ ਵੀਂ ਵਰ੍ਹੇਗੰਢ ਸੀਗੀ ਅਤੇ ਮੇਰੇ ਸਕੂਲ ਵੱਲੋਂ ਮੈਨੂੰ ਚੁਣਿਆ ਗਿਆ ਕਿ ਮੈਂ ਇਸ ਦੇ ਵਿੱਚ ਹਿੱਸਾ ਲਵਾਂ ਮੇਰੇ ਅਧਿਆਪਕ ਸਾਹਿਬਾਨਾਂ ਨੇ ਬਹੁਤ ਹੀ ਜ਼ੋਰ ਪਾ ਕੇ ਮੈਨੂੰ ਇਸ ਦੇ ਵਿੱਚ ਹਿੱਸਾ ਲੈਣ ਲਈ ਮਨਾ ਲਿਆ ਮੈਨੂੰ ਬਿਲਕੁਲ ਆਸ ਨਹੀਂ ਸੀਗੀ ਕਿ ਮੈਂ ਜ਼ਿਲ੍ਹਾ ਪੱਧਰੀ ਮੁਕਾਬਲੇ ਦੇ ਵਿੱਚ ਪੁਜ਼ੀਸ਼ਨ ਲੈ ਸਕਾਂਗੀ ਪਰ ਫਿਰ ਵੀ ਮੈਂ ਪੂਰਾ ਜ਼ੋਰਦਾਰ ਮੁਕਾਬਲਾ ਕੀਤਾ ਕਵਿਤਾ ਦਾ ਮੁਕਾਬਲਾ ਸੀਗਾ ਜਿੱਦਾਂ ਕਿ ਮੈਂ ਆਪਣੀ ਤਿਆਰੀ ਕੀਤੀ ਸੀ ਮੈਂ ਉਦਾਂ ਹੀ ਜੱਜਿਸ ਦੇ ਅੱਗੇ ਆਪਣੀ ਤਿਆਰੀ ਦਿਖਾ ਦਿੱਤੀ ਦੂਜਿਆਂ ਨੇ ਵੀ ਬਹੁਤ ਵਧੀਆ ਕੀਤਾ ਮੈਨੂੰ ਮੈਂ ਉੱਥੇ ਦੇਖਦੀ ਰਹੀ ਸਾਰਿਆਂ ਦੇ ਜਦੋਂ ਤਾਂ ਮੈਨੂੰ ਲੱਗਿਆ ਕਿ ਨਹੀਂ ਮੇਰੀ ਪੁਜ਼ੀਸ਼ਨ ਨਹੀਂ ਆਉਣੀ ਮੇਰੇ ਨਾਲੋਂ ਜ਼ਿਆਦਾ ਵਧੀਆ ਤਾਂ ਬਾਕੀ ਦੇ ਕੈਂਡੀਡੇਟਸ ਕਰ ਰਹੇ ਨੇ ਪਰ ਜਦੋਂ ਰਿਜ਼ਲਟ ਆਇਆ ਮੈਂ ਟੀਚਰਸ ਨੂੰ ਵੀ ਕਹਿ ਦਿੱਤਾ ਕਿ ਨਹੀਂ ਮੈਮ ਮੇਰੀ ਪੁਜ਼ੀਸ਼ਨ ਨਹੀਂ ਆਉਣੀ ਟੀਚਰਸ ਕਹਿੰਦੇ ਕਿ ਨਹੀਂ ਰਿਜ਼ਲਟ ਸੁਣੋ ਜਦੋਂ ਰਿਜ਼ਲਟ ਸੁਣਿਆ ਉਹਨਾਂ ਨੇ ਮੇਰਾ ਨਾਮ ਅਨਾਊਂਸ ਕੀਤਾ ਜਦੋਂ ਤਾਂ ਮੈਂ ਖੁਸ਼ੀ ਦੇ ਵਿੱਚ ਚੀਕ ਚੀਕਾਂ ਮਾਰ ਉੱਠੀ ਮੈਨੂੰ ਨਹੀਂ ਯਕੀਨ ਹੋ ਰਿਹਾ ਸੀਗਾ ਕਿ ਮੇਰੀ ਪੁਜ਼ੀਸ਼ਨ ਆ ਗਈ ਸਾਰੇ ਸਾ ਟੀਚਰ ਸਾਹਿਬਾਨਾਂ ਨੂੰ ਮੇਰੇ ਉੱਤੇ ਇੱਕ ਫਕਰ ਮਹਿਸੂਸ ਹੋਇਆ ਸਭ ਨੇ ਮੈਨੂੰ ਵਧਾਈਆਂ ਦਿੱਤੀਆਂ ਮੈਂ ਜਦੋਂ ਸਕੂਲ 'ਚ ਗਈ ਤਾਂ ਸਵੇਰ ਦੀ ਪ੍ਰਾਥਨਾ ਦੇ ਵੇਲੇ ਮੇਰਾ ਉੱਥੇ ਨਾਮ ਅਨਾਊਂਸ ਹੋਇਆ ਅਤੇ ਸਭ ਨੇ ਮੇਰੇ ਨਾਂ 'ਤੇ ਤਾੜੀਆਂ ਮਾਰੀਆਂ ਘਰ ਆ ਕੇ ਵੀ ਮੈਨੂੰ ਸਾਰਿਆਂ ਨੇ ਸਲਾਹਿਆ ਮੈਨੂੰ ਮੇਰੇ ਮੰਮੀ ਡੈਡੀ ਨੇ ਵੀ ਕਿਹਾ ਕਿ ਤੂੰ ਬਹੁਤ ਹੀ ਵਧੀਆ ਮਾਣ ਵਾਲਾ ਕੰਮ ਕੀਤਾ ਆ ਮੈਨੂੰ ਉਦੋਂ ਮਹਿਸੂਸ ਹੋਇਆ ਕਿ ਸੱਚੀ ਇਹ ਮੇਰੇ ਲਈ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਮੈਂ ਜ਼ਿਲ੍ਹਾ ਪੱਧਰੀ ਮੁਕਾਬਲੇ ਦੇ ਵਿੱਚੋਂ ਪੁਜ਼ੀਸ਼ਨ ਹਾਸਲ ਕਰ ਸਕੀ